ਔਨਲਾਈਨ ਅਤੇ ਸ਼ੋਸ਼ਲ ਮੀਡੀਆ ਪਲੇਟਫਾਰਮ ਪੰਜਾਬ ਵਿੱਚ ਸਿੱਖਿਆ ਦੇ ਖੇਤਰ ਵਿੱਚ ਬਹੁਤ ਹੀ ਵੱਡਾ ਅਤੇ ਅਹਿਮ ਯੋਗਦਾਨ ਨਿਭਾਉਂਦੇ ਆ ਰਹੇ ਹਨ ਕਿਉਂਕਿ ਪਿਛਲੇ ਸਮੇਂ ਦੇ ਅੰਦਰ ਚਿੱਠੀ ਪੱਤਰ ਪਹੁੰਚਾਉਣ ਦੇ ਲਈ ਬਹੁਤ ਲੰਮਾ ਸਮਾਂ ਲੱਗਦਾ ਸੀ ਅਤੇ ਉਸਦਾ ਜਵਾਬ ਪ੍ਰਾਪਤ ਕਰਨ ਦੇ ਲਈ ਉਸ ਤੋਂ ਵੀ ਵੱਧ ਸਮਾਂ ਲੱਗਦਾ ਸੀ ਜਦੋਂ ਦਾ ਸ਼ੋਸ਼ਲ ਮੀਡੀਆ ਅਤੇ ਔਨਲਾਈਨ ਪਲੇਟਫਾਰਮ ਨੇ ਸਿੱਖਿਆ ਦੇ ਖੇਤਰ ਦੇ ਵਿੱਚ ਪੈਰ ਪਸਾਰੇ ਨੇ ਹੁਣ ਅਸੀਂ ਈਮੇਲ ਰਾਹੀਂ ਜਾਂ ਸ਼ੋਸ਼ਲ ਮੀਡੀਏ ਵੱਟਸਅੱਪ ਦੇ ਰਾਹੀਂ ਜਾਂ ਔਨਲਾਈਨ ਦੇ ਰਾਹੀਂ ਛੇਤੀ ਜਵਾਬ ਦੇ ਸਕਦੇ ਹਾਂ ਅਤੇ ਪ੍ਰਾਪਤ ਕਰ ਸਕਦੇ ਹਾਂ ਈ ਫਾਈਲਿੰਗ ਸਿਸਟਮ ਔਨਲਾਈਨ ਸਿਸਟਮ ਦੇ ਰਾਹੀਂ ਵੀ ਸਾਡਾ ਜਿਹੜਾ ਸਿੱਖਿਆ ਦਾ ਖੇਤਰ ਹੈ ਉਹ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਹਨ